ਪੰਜ ਹਜ਼ਾਰ ਚਾਰ ਸੌ ਤੀਹ ਦੋ ਹਜ਼ਾਰ ਪੰਜ ਸੌ ਪੰਜਾਹ ਛੇ ਹਜ਼ਾਰ ਤਿੰਨ ਸੌ ਤੇਰਾਂ ਸੱਠ ਲੱਖ ਬਾਰਾਂ ਹਜ਼ਾਰ ਛੇ ਸੌ ਪੰਦਰਾਂ ਅੱਠ ਲੱਖ ਬਾਹਠ ਹਜ਼ਾਰ ਪੰਜ ਸੌ ਪੱਚੀ